ਟੈਕਨੋਲੋਜੀ ਨੇ ਲੋਕਾਂ ਦੀ ਖੇ ਬਹੁਤ ਸਾਰੀ ਮਦਦ ਕੀਤੀ ਹੈ ਜਿਵੇਂ ਕਿ ਖੇਤੀਬਾੜੀ ਪਹਿਲਾਂ ਲੋਕੀਂ ਬਲਦਾਂ ਨਾਲ ਖੇਤੀਬਾੜੀ ਕਰਦੇ ਸੀਗੇ ਜੋ ਕੰਮ ਚਾਰ ਦਿਨਾਂ ਦਾ ਹੁੰਦਾ ਸੀਗਾ ਉਹ ਟੈਕਨੋਲੋਜੀ ਨਾਲ ਉਹ ਇੱਕ ਦਿਨ ਵਿੱਚ ਹੀ ਨਿਬੜ ਜਾਂਦਾ ਹੈ ਤਾਂ ਇੱਕ ਤਾਂ ਟਾਇਮ ਦੀ ਬੱਚਤ ਹੁੰਦੀ ਹੈ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਲੋਕੀਂ ਆਪਣਾ ਕੰਮ ਬਹੁਤ ਵਧੀਆ ਕਰ ਲੈਂਦੇ ਹਨ ਅਤੇ ਮੱਛੀ ਪਾਲਣ ਮੱਛੀ ਪਾਲਣ ਜਿਵੇਂ ਕਿ ਪਹਿਲੇ ਜ਼ਮਾਨੇ 'ਚ ਮੱਛੀਆਂ ਨੂੰ ਬਿਮਾਰੀ ਲੱਗ ਜਾਂਦੀਆਂ ਸੀਗੀਆਂ ਲੋਕਾਂ ਨੂੰ ਬੜੇ ਬੜੇ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ ਅਤੇ ਹੁਣ ਨਵੀਂ ਟੈਕਨੋਲੋਜੀ ਆ ਗਈ ਅਤੇ ਲੋਕ ਫ਼ੋਨ 'ਤੇ ਗੱਲਾਂ ਕਰ ਲੈਂਦੇ ਹਨ ਅਤੇ ਫ਼ੋਨ 'ਤੇ ਦਵਾਈ ਮੰਗਵਾ ਲੈਂਦੇ ਹਨ ਅਤੇ ਪ ਦੁੱਧ ਪਾ ਦਿੰਦੇ ਦੁੱਧ ਲੋਕੀਂ ਪਹਿਲੇ ਜ਼ਮਾਨੇ 'ਚ ਦੁੱਧ ਵੇਚਣ ਬਾਹਰ ਜਾਂਦੇ ਸੀ ਡੇਅਰੀਆਂ ਦੇ ਉੱਤੇ ਹੁਣ ਅੱਜ ਕੱਲ੍ਹ ਦੇ ਨਵੇਂ ਟੈਕਨੀਕ ਦੇ ਵਿੱਚ ਦੁੱਧ ਦੇ ਡੇਅਰੀ ਵਾਲੇ ਲੋਕਾਂ ਤੋਂ ਦੁੱਧ ਘਰ ਹੀ ਔਨਲਾਈਨ ਮੰਗਵਾ ਲੈਂਦੇ ਅਤੇ ਘਰ ਤੋਂ ਆ ਕੇ ਚੁੱਕ ਲੈਂਦੇ ਹਨ ਖੇਤੀਬਾੜੀ ਟੈਕਨੋਲੋਜੀ ਨੇ ਨੇ ਲੋਕਾਂ ਦੀ ਬਹੁਤ ਸਾਰੀ ਮਦਦ ਕੀਤੀ ਹੈ ਅੱਗੇ ਲੋਕ ਖਾਦ ਖਰੀਦਣ ਲਈ ਸ਼ਹਿਰ ਤੋਂ ਬਾਹਰ ਜਾਂਦੇ ਪਿੰਡਾਂ ਤੋਂ ਬਾਹਰ ਜਾਂਦੇ ਸੀਗੇ ਅਤੇ ਹੁਣ ਔਨਲਾਈਨ ਟੈਕਨੀਕ ਦੇ ਨਾਲ ਲੋਕਾਂ ਨੂੰ ਘਰ ਬੈਠੇ ਮਦਦ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਇਸ ਚੀਜ਼ ਦਾ ਤਾਂ ਅਤੇ ਲੋਕਾਂ ਨੂੰ ਹੁਣ ਬਹੁਤ ਸਾਰੇ ਸਿੱਖ ਸਹੂਲਤਾਂ ਮਿਲ ਜਾਂਦੀਆਂ ਹਨ